ਪਿੰਡਾਂ ਅਤੇ ਸ਼ਹਿਰਾਂ ਵਿੱਚ ਖੇਡਾਂ ਖੇਡਣ ਦਾ ਇਹ ਅੰਤਰ ਹੈ ਕਿ ਪਿੰਡ ਵਿੱਚ ਬੱਚੇ ਪਲਾਟ ਜਾਂ ਖਾਲੀ ਮੈਦਾਨ ਵਿੱਚ ਜਾ ਕੇ ਖੇਡਦੇ ਹਨ ਜੇ ਖਾਲੀ ਪਲਾਟ ਜਾਂ ਮੈਦਾਨ ਨਾ ਹੋਵੇ ਗਲੀ ਵਿੱਚ ਵੀ ਖੇਡਣ ਲੱਗ ਜਾਂਦੇ ਹਨ ਅਤੇ ਸ਼ਹਿਰ ਦੇ ਜਵਾਕ ਆਪਣਾ ਕੋਈ ਪਲੇਅਗਰਾਉਂਡ ਜਾਂ ਮਿਊਜਮੈਂਟ ਪਾਰਕ ਵਿੱਚ ਜਾ ਕੇ ਖੇਡਦੇ ਹਨ ਜੋ ਕਿ ਗਲੀ ਵਿੱਚ ਕਦੀ ਨਹੀਂ ਖੇਡਦੇ ਜ਼ਿਆਦਾਤਰ ਸ਼ਹਿਰ ਦੇ ਜਵਾਕ ਘਰ ਤੋਂ ਬਾਹਰ ਨਹੀਂ ਨਿਕਲਦੇ ਜ਼ਿਆਦਾਤਰ ਪਿੰਡ ਦੇ ਜਵਾਕ ਗਲੀ ਜਾਂ ਪਲਾਟਾਂ ਵਿੱਚ ਹੀ ਖੇਡਦੇ ਹਨ